ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਮੈਂ ਅਵੇਅਰਨੈਸ ਕੈਂਪ ਲਵਾਉਣ ਆਈ ਹਾਂ ਇਨਵਾਰਮੈਂਟ ਬਾਰੇ ਪਲਾਂਟ ਟਰੀ ਪਲਾਂਟੇਸ਼ਨ ਬਾਰੇ ਮੈਮ ਸਾਡੀ ਡਿਊਟੀ ਲੱਗੀ ਅਸੀਂ ਡੋਰ ਟੂ ਡੋਰ ਵਿਜਿਟ ਕਰਕੇ ਟਰੀ ਟਰੀ ਪਲਾਂਟੇਸ਼ਨ ਬਾਰੇ ਦੱਸਣਾ ਮੈਮ ਇਹਦੇ 'ਚ ਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਤੁਹਾਡਾ ਇਹੀ ਘਰ ਆ ਨਾ ਮੈਮ ਓਕੇ ਓ ਠੀਕ ਹੈ ਠੀਕ ਹੈ ਮੈਮ ਜਿੱਦਾਂ ਕਿ ਤੁਹਾਨੂੰ ਪਤਾ ਕਿ ਸ਼ਹਿਰਾਂ ਦੇ ਵਿੱਚ ਆਪਣੇ ਕੋਲ ਰਹਿਣ ਲਈ ਜਿਹੜੀ ਜਗ੍ਹਾ ਉਹ ਲਿਮਿਟਡ ਹੁੰਦੀ ਆ ਹਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਿਰਫ ਚਾਰ ਮਰਲੇ ਜਾਂ ਪੰਜ ਮਰਲੇ ਵਿੱਚ ਘਰ ਹੀ ਹੁੰਦਾ ਪਰ ਫਿਰ ਵੀ ਆਪਾਂ ਜਿਹੜਾ ਟਰੀਜ ਦੀ ਇਮਪੋਰਟੈਂਟ ਆ ਇਹਨੂੰ ਆਪਾਂ ਘੱਟ ਨਹੀਂ ਕਰ ਸਕਦੇ ਹੈ ਨਾ ਇੰਨੇ ਇੰਪੋਰਟੈਂਟ ਨੂੰ ਧਿਆਨ ਵਿੱਚ ਆਪਾਂ ਨੂੰ ਰੱਖਣਾ ਹੀ ਪਾਊਗਾ ਅਤੇ ਇਹਦੇ ਲਈ ਮੈਂ ਤੁਹਾਨੂੰ ਇਹ ਚੀਜ਼ ਦੱਸੂਗੀ ਕਿ ਕਿਹੜੇ ਕਿਹੜੇ ਆਪਣੇ ਜਿਹੜੇ ਟਰੀਜ ਆ ਆਪਾਂ ਉਹ ਘਰ ਵਿੱਚ ਲਗਾ ਸਕਦੇ ਹਾਂ ਹਾਂ ਮੈਮ ਜਿੱਦਾਂ ਤੁਹਾਡੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਜਿਹੜੇ ਅਸੀਂ ਟਰੀ ਕਰ ਰਹੇ ਹਾਂ ਤੁਹਾਨੂੰ ਇਹ ਅਸੀਂ ਆਪਣੇ ਆਪ ਤੁਹਾਨੂੰ ਫਰੀ ਪ੍ਰੋਵਾਈਡ ਕਰਵਾਵਾਂਗੇ ਅੱਜ ਜਿੱਦਾਂ ਮੈਂ ਸਿਰਫ ਸਰਵੇ ਕਰਨ ਆਈ ਹਾਂ ਹੁਣ ਕੱਲ੍ਹ ਨੂੰ ਸਾਡੀ ਟੀਮ ਆਉਗੀ ਇਹ ਤੁਹਾਨੂੰ ਟਵੀਜ਼ ਜਿਹੜੇ ਆ ਉਹ ਵੰਡ ਕੇ ਜਾਣਗੇ ਅਤੇ ਇਹਦੇ ਨਾਲ ਤੁਸੀਂ ਆਪਣੇ ਘਰ ਵਿੱਚ ਟਰੀਜ਼ ਲਗਾ ਸਕਦੇ ਹੋ ਜਿੰਨੇ ਤੁਹਾਨੂੰ ਸਪੇਜ਼ ਹੈਗੀ ਆ ਉਹਦੇ ਅਕੋਡਿੰਗ ਜਿੱਦਾਂ ਮੈਮ ਆਹ ਤੁਹਾਡੀ ਬਾਲਕਨੀ ਦਿਖ ਰਹੀ ਆ ਇੱਥੇ ਤੁਹਾਡੇ ਬਹੁਤ ਵਧੀਆ ਟਰੀ ਲੱਗ ਸਕਦੇ ਆ ਤੁਸੀਂ ਜਿਵੇਂ ਸਪੈਡਰ ਟਰੀ ਹੈਗਾ ਹੈ ਨਾ ਸਪੈਡਰ ਪਲਾਂਟ ਹੋ ਗਿਆ ਮਨੀ ਪਲਾਂਟ ਹੋ ਗਿਆ ਇਹ ਜਿਹੜੇ ਟਰੀਜ਼ ਆ ਇਹ ਤੁਸੀਂ ਪਲਾਂਟ ਕਰ ਸਕਦੇ ਇੱਥੇ ਹੋਰ ਜਿਹੜੀਆਂ ਕੁਝ ਕਾਫੀ ਜ਼ਿਆਦਾ ਡੈਕੋਰੇਟ ਵਾਲੀਆਂ ਵੇਲਾਂ ਹੁੰਦੀਆਂ ਉਹ ਵੀ ਤੁਸੀਂ ਕਰ ਸਕਦੇ ਹੋ ਇਹ ਸਾਰੀਆਂ ਤੁਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਹਾਂਜੀ ਹਾਂਜੀ ਤੁਹਾਨੂੰ ਹਰੇਕ ਤਰ੍ਹਾਂ ਦਾ ਪਲਾਂਟ ਮਿਲੇਗਾ ਬਟ ਜਿਹੜੇ ਫਲਾਵਰ ਵਾਲੇ ਪਲਾਂਟ ਆ ਇਹ ਥੋੜ੍ਹਾ ਡੈਕੋਰੇਸ਼ਨ 'ਚ ਆ ਜਾਂਦੇ ਆ ਇਸ ਕਰਕੇ ਥੋੜ੍ਹੇ ਜਿਹੇ ਤੁਹਾਨੂੰ ਇਹਨਾਂ ਦਾ ਪ੍ਰਾਈਜ ਹੋਏਗਾ ਪਰ ਤੁਸੀਂ ਮਾਰਕੀਟ ਨਾਲ ਤੁਹਾਨੂੰ ਬਹੁਤ ਲੈਸ ਪ੍ਰਾਈਜ਼ 'ਚ ਇਹ ਮਿਲਣਗੇ ਅਤੇ ਹਾਂਜੀ ਹਾਂਜੀ ਮੈਮ ਸਿਰਫ ਇਹਨਾਂ ਲਈ ਤਾਂ ਠੀਕ ਪ੍ਰਾਈਜ਼ ਆ ਹਰੇਕ ਤੁਹਾਨੂੰ ਪਲਾਂਟ ਦਾ ਸਿਰਫ ਦਸ ਰੁਪਏ ਦੇਣੇ ਪੈਣਗੇ ਔਰ ਇਹ ਜਿਹੜੇ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ ਇਹਨਾਂ ਦੇ ਪਲਾਂਟੇਸ਼ਨ ਦੀ ਕੋਸਟ ਆ ਇਹਨੂੰ ਅਸੀਂ ਡੋਨੇਟ ਕਰਨਾ ਵਾ ਆ ਆਸ਼ਰਮ ਦੇ ਵਿੱਚ ਜਿਹੜਾ ਆਪਣੇ ਲੋਕਲ ਆਸ਼ਰਮ ਹੈਗਾ ਇੱਥੇ ਡੋਨੇਟ ਕਰਨਾ ਹੋਰ ਇਹਦਾ ਕੋਈ ਸਾਨੂੰ ਹੈ ਨਹੀਂ ਅਤੇ ਤੁਸੀਂ ਮੈਮ ਤੁਹਾਡਾ ਅਸੀਂ ਦੱਸ ਸਕਦੇ ਤੁਸੀਂ ਕਿੰਨੇ ਪਲਾਂਟ ਖਰੀਦੋਗੇ ਸਾਡੇ ਕੋਲ ਕਿੰਨੇ ਪਲਾਂਟ ਤੁਸੀਂ ਲਗਾ ਸਕਦੇ ਹੋ ਆਪਣੇ ਘਰ ਵਿੱਚ ਹਾਂਜੀ ਹਾਂਜੀ ਮੈਮ ਤੁਸੀਂ ਆਰਾਮ ਨਾਲ ਛੇ ਪਲਾਂਟ ਇੱਥੇ ਲਗਾ ਸਕਦੇ ਹੋ ਮੈਮ ਇੱਕ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹ ਰਹੇ ਹਾਂ ਅਸੀਂ ਜਿਹੜੇ ਸਾਨੂੰ ਜ਼ਰੂਰ ਮੈਨੂੰ ਲੱਗਦਾ ਕਿ ਸ਼ੇਅਰ ਕਰਨੀ ਚਾਹੀਦੀ ਆ ਤੁਸੀਂ ਇੱਕ ਇਨਵਾਇਰਮੈਂਟਲਿਸਟ ਬਾਰੇ ਸੁਣਿਆ ਹੋਣਾ ਸਾਲੋਦੀਨ ਮਾਰਦੀਨ ਮੱਕਾ ਜਿਹੜੀ ਕਿ ਬਹੁਤ ਹੀ ਓਲਡ ਲੇਡੀ ਆ ਇੱਕ ਸੌ ਦਸ ਸਾਲ ਉਹਨਾਂ ਦੀ ਉਮਰ ਹੋ ਚੁੱਕੀ ਹੈ ਔਰ ਉਹ ਮੈਮ ਜੀ ਦਾ ਇੱਕ ਖਾਸ ਉਪਰਾਲਾ ਆ ਕਿ ਹਰ ਜਗ੍ਹਾ 'ਤੇ ਪਲਾਂਟੇਸ਼ਨ ਹੋਵੇ ਉਹਨਾਂ ਦੀ ਇੱਕ ਚਲਾਈ ਹੋਈ ਸੰਸਥਾ ਆ ਜਿਹਦੇ ਵਿੱਚ ਮੈਂ ਕੰਮ ਕਰਦੀ ਹਾਂ ਔਰ ਤੁਹਾਨੂੰ ਪਲਾਂਟੇਸ਼ਨ ਬਾਰੇ ਦੱਸ ਰਹੀ ਹਾਂ ਉਹਨਾਂ ਦੇ ਵੱਲੋਂ ਹੀ ਇਹ ਜਿਹੜੇ ਪਲਾਂਟ ਭੇਜੇ ਜਾ ਰਹੇ ਆ ਤੁਹਾਨੂੰ ਫਰੀ ਆਫ ਕੋਸਟ ਔਰ ਹਰੇਕ ਦਲਾਂ 'ਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਲਗਾ ਰਹੇ ਹਾਂ ਅਤੇ ਮੈਮ ਤੁਸੀਂ ਆਪਣੇ ਨਾਲ ਤੁਸੀਂ ਹੋਰ ਵੀ ਆਪਣੇ ਨੇਬਰਹੁੱਡ ਵਿੱਚ ਬੁਲਾ ਸਕਦੇ ਹੋ ਉਹਨਾਂ ਨੂੰ ਅਸੀਂ ਉਹਨਾਂ ਨਾਲ ਵੀ ਡਿਸਕਸ ਕਰ ਲਈਏ ਜਾਂ ਤੁਸੀਂ ਖੁਦ ਹੀ ਉਹਨਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰ ਸਕਦੇ ਹੋ ਕੱਲ੍ਹ ਨੂੰ ਯਾਨੀ ਕਿ ਆਪਾਂ ਇੱਕ ਟਾਈਮ ਫਿਕਸ ਕਰ ਲਈਏ ਕਿ ਕੱਲ੍ਹ ਨੂੰ ਤੁਸੀਂ ਇਸ ਟਾਈਮ ਇਕੱਠੇ ਹੋ ਜਾਣਾ ਆਪਾਂ ਸਾਰਿਆਂ ਨੂੰ ਪਲਾਂਟ ਵੰਡ ਦਈਏ ਹਾਂਜੀ ਹਾਂਜੀ ਬਿਲਕੁਲ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਬਿਲਕੁਲ ਤੁਸੀਂ ਬਹੁਤ ਵਧੀਆ ਸੋਚ ਰੱਖਦੇ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਜ਼ਰੂਰ ਸਾਥ ਦਿਓਗੇ ਔਰ ਮੈਮ ਹਾਂਜੀ ਤੁਹਾਨੂੰ ਹਾਂਜੀ ਤੁਹਾਨੂੰ ਡੈਕੋਰੇਸ਼ਨ ਦੇ ਨਾਲ ਨਾਲ ਤੁਹਾਨੂੰ ਗਰੀਨਰੀ ਵੀ ਦਊਗਾ ਫਰੈਸ਼ ਫਰੈਸ਼ ਏਅਰ ਵੀ ਤੁਹਾਨੂੰ ਮਿਲੂਗੀ ਇਹਨਾਂ ਪਲਾਂਟਾਂ ਤੋਂ ਆਪਣਾ ਹੀ ਫਾਇਦਾ ਆਪਾਂ ਜਿੰਨੇ ਪਲਾਂਟ ਕਰਾਂਗੇ ਤਾਂ ਮੈਮ ਮੈਂ ਕੱਲ੍ਹ ਤੁਹਾਨੂੰ ਲਿਆਉਂਗੀ ਠੀਕ ਹੈ ਮੈਮ ਥੈਂਕ ਯੂ ਸੋ ਮਚ ਨੌ ਨੌ ਕੁ ਵਜੇ ਤੱਕ ਜ਼ਰੂਰ ਆ ਜਾਵਾਂਗੇ ਇੱਥੇ ਮੈਮ ਠੀਕ ਹੈ ਤੁਸੀਂ ਨੌ ਕੁ ਵਜੇ ਦੀ ਮੀਟਿੰਗ ਡਨ ਰੱਖੋ ਆਪਣੀ ਓਕੇ ਥੈਂਕ ਯੂ ਮੈਮ